ਇੱਕ ਕਲਾਕਾਰ ਦੇ ਰੂਪ ਵਿੱਚ ਮੈਂ ਬਹੁਤ ਹੀ ਜ਼ਿਆਦਾ ਕਠਿਨਾਈਆਂ ਨੂੰ ਕਠਿਨਾਈਆਂ ਦਾ ਸਾਹਮਣਾ ਕੀਤਾ ਹੈ ਕਿਉਂਕਿ ਮੈਨੂੰ ਆਪਣੀ ਮਾਲੀ ਹਾਲਤ ਦੇ ਕਾਰਨ ਬਹੁਤ ਹੀ ਘੱਟ ਚੀਜ਼ਾਂ ਦੇ ਚੀਜ਼ਾਂ ਦੇ ਕਾ ਹੋਣ ਦੇ ਕਾਰਨ ਮੈਨੂੰ ਵਧੀਆ ਤੋਂ ਵਧੀਆ ਪੇਜ ਜਾਂ ਕਲਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੀ ਮੈਂ ਕਦੇ ਸਲੇਟਾਂ ਦੇ ਉੱਤੇ ਉਸਨੂੰ ਦੁਬਾਰਾ ਦੁਬਾਰਾ ਬਣਾ ਕੇ ਉਸਨੂੰ ਮਿਟਾ ਕੇ ਉਹੀ ਉਹੀ ਸਲੇਟ ਨੂੰ ਫਿਰ ਯੂਜ ਕਰ ਲੈਂਦਾ ਸੀ ਮੈਂ ਕਦੇ ਵੀ ਨਵੇਂ ਤੋਂ ਨਵੇਂ ਡਰਾਇੰਗ ਦੀਆਂ ਕਾਪੀਆਂ ਨਹੀਂ ਖਰੀਦ ਸਕਦਾ ਸੀ ਇਸ ਤਰ੍ਹਾਂ ਮੈਂ ਸਟੇਸ਼ਨਰੀ ਦੀ ਸਪਲਾਈ ਨੂੰ ਕਮੀ ਦੇ ਤੌਰ 'ਤੇ ਅਨੁਭਵ ਕੀਤਾ ਹੈ ਅਤੇ ਮੈਨੂੰ ਇਸ ਦੀ ਪ੍ਰੇਰਨਾ ਦੇ ਵਿੱਚ ਕੋਈ ਵੀ ਕਮੀ ਨਹੀਂ ਸੀ ਨਜ਼ਰ ਆਉਂਦੀ ਪਰ ਮੈਂ ਜੋ ਵੀ ਇਸ ਨੂੰ ਅੱਗੇ ਆਪਣੇ ਲੈ ਕੇ ਜਾਣਾ ਚਾਹੁੰਦਾ ਸੀ ਮੈਂ ਉਸ ਨੂੰ ਯੂਟੀਊਬ ਦੇ ਰਾਹੀਂ ਇੰਟਰਨੈਟ ਦੇ ਰਾਹੀਂ ਉੱਥੇ ਦੇਖ ਕੇ ਆਪਣੀ ਵਧੀਆ ਤੋਂ ਵਧੀਆ ਚਿੱਤਰਕਾਰੀ ਨੂੰ ਕਰਨ ਦਾ ਅਨੁਭਵ ਪ੍ਰਗਟ ਕਰਦਾ ਸੀ ਅਤੇ ਮੈਂ ਜੋ ਵੀ ਕੋਈ ਇਸ ਨੂੰ ਕਰਨਾ ਚਾਹੁੰਦਾ ਹੈ ਉਸ ਨੂੰ ਇਹੀ ਸਲਾਹ ਦੇਵਾਂਗਾ ਕਿ ਅੱਜ ਦੀ ਤਰੀਕ ਦੇ ਵਿੱਚ ਅਤੇ ਪਹਿਲੇ ਜ਼ਮਾਨੇ ਦੇ ਵਿੱਚ ਬਹੁਤ ਹੀ ਫਰਕ ਸੀਗਾ ਜੋ ਕਿ ਅੱਜ ਉਹ ਬਹੁਤ ਆਸਾਨ ਹੈ ਧੰਨਵਾਦ